ਹੈਲੋ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਜੀ ਹਾਂਜੀ ਹਾਂਜੀ ਸਾਰੇ ਠੀਕ ਠਾਕ ਆ ਜੀ ਤੁਸੀਂ ਸੁਣਾਓ ਆਪਣਾ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਜ਼ਰੂਰ ਹਾਂਜੀ ਹਾਂਜੀ ਤੁਸੀਂ ਏ ਇੱਕ ਦਿਨ ਦਾ ਟਰਿਪ ਵਾਸਤੇ ਕਰਨਾ ਜਾਂ ਵੀਕ ਦਾ ਜੀ ਫੈਮਲੀ ਇੱਕ ਦਿਨ ਦਾ ਜੀ ਓਕੇ ਓਕੇ ਇੱਕ ਦਿਨ ਆਪਾਂ ਜੀ ਇੱਕ ਤਾਂ ਬਠਿੰਡੇ ਸਭ ਤੋਂ ਮਸ਼ਹੂਰ ਕਿਲ੍ਹਾ ਸਾਹਿਬ ਆ ਆਪਾਂ ਉਹ ਦੇਖ ਸਕਦੇ ਹਾਂ ਉਹ ਬਹੁਤ ਇਤਿਹਾਸਿਕ ਹੈ ਇੱਕ ਬਠਿੰਡੇ ਵਿਚ ਜੀ ਹਾਜੀ ਰਤਨ ਗੁਰਦੁਆਰਾ ਸਾਹਿਬ ਹੈ ਆਪਾਂ ਗੁਰਦੁਆਰਾ ਸਾਹਿਬ ਜਾ ਦੇਖਣ ਯੋਗ ਹੈ ਉਸ ਤੋਂ ਬਾਅਦ ਜੇ ਆਪਾਂ ਫੈਮਿਲੀ ਨਾਲ ਆਏ ਹਾਂ ਮੂਵੀ ਮਾਵੀ ਦੇਖਣ ਦਾ ਪ੍ਰੋਗਰਾਮ ਹੁੰਦਾ ਜਾਂ ਸ਼ੋਪਿੰਗ ਦਾ ਮਨ ਹੁੰਦਾ ਉਹਦੇ ਵਾਸਤੇ ਮਿੱਤਲ ਮੋਲ ਬਹੁਤ ਵਧੀਆ ਆਪਸ਼ਨ ਹੈ ਮਿੱਤਲ ਮੋਲ ਦੇ ਵਿੱਚ ਹਰੇਕ ਬ੍ਰਾਂਡ ਦੀ ਸ਼ੋਰੂਮ ਹੈਗੇ ਆ ਥਿਏਟਰ ਹੈਗੇ ਆ ਹਰੇਕ ਫੂਡ ਫੂਡ ਵਾਲੇ ਹੈਗੇ ਆ ਕੇ ਐਫ ਸੀ ਹੋ ਗਿਆ ਮੈਕਡੋਨਲਸ ਹੋ ਗਿਆ ਹਰ ਤਰ੍ਹਾ ਦੀ ਚੇਨ ਹੈਗੀ ਹੈ ਉਹ ਬੱਚਿਆਂ ਵਾਸਤੇ ਬਹੁਤ ਵਧੀਆ ਰਹੇਗਾ ਉਸ ਤੋਂ ਬਾਅਦ ਆਪਾਂ ਝੀਲਾਂ 'ਤੇ ਜਾ ਸਕਦੇ ਹਾਂ ਝੀਲਾਂ 'ਤੇ ਵੀ ਬਹੁਤ ਵਧੀਆ ਨਜ਼ਾਰਾ ਵਾ ਉੱਥੇ ਆਪਾਂ ਵੋਟਿੰਗ ਕਰ ਸਕਦੇ ਹਾਂ ਅਤੇ ਇੱਕ ਹਾਂ ਛੁੱਟੀਆ ਵਿੱਚ ਇੱਕ ਸਭ ਤੋਂ ਮੇਨ ਚੀਜ਼ ਰੋਜ਼ ਗਾਰਡਨ ਕੋਲ ਇੱਕ ਐਡਵੈਂਚਰ ਪਾਰਕ ਜਾਂ ਮੇਲਾ ਆਇਆ ਹੋਇਆ ਜੋ ਕਿ ਬੱਚਿਆਂ ਵਾਸਤੇ ਬਹੁਤ ਵਧੀਆ ਉੱਥੇ ਤਰ੍ਹਾਂ ਤਰ੍ਹਾਂ ਦੇ ਝੂਲੇ ਹੈ ਰਾਈਡਸ ਖਾਣ ਪੀਣ ਦਾ ਵਾ ਹੋਰ ਬਹੁਤ ਕੁਛ ਆਇਆ ਵਾ ਉਹ ਬੱਚਿਆਂ ਵਾਸਤੇ ਬਹੁਤ ਇੰਟਰਟੇਨਮੈਂਟ ਰਹੇਗਾ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਤੁਸੀਂ ਜਦੋਂ ਮਰਜ਼ੀ ਆਓ ਮੈਂ ਫਰੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਵੀ ਆਪਣੀ ਫੈਮਲੀ ਨਾਲ ਅੱਜ ਕਰ ਲੈਂਦਾ ਆਪਾਂ ਇਕੱਠੇ ਆਪਣੀ ਫੈਮਲੀ ਲੈ ਕੇ ਚੱਲ ਚੱਲ ਕਰ ਲੈਂਦੇ ਇੱਕ ਦਿਨ ਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਾਲੇ ਬੱਚਿਆਂ ਦੀ ਛੁੱਟੀ ਦਾ ਥੋੜ੍ਹਾ ਇੰਟਰਟੇਨਮੈਂਟ ਹੋਜੂ ਬੱਚੇ ਵੀ ਥੋੜ੍ਹੇ ਜਿਹੇ ਖੁਸ਼ ਹੋ ਜਾਣਗੇ ਨਾਲੇ ਆਪਣੇ ਇਸੀ ਬਹਾਨੇ ਫੈਮਲੀ ਇੱਕ ਦੂਜੇ ਨਾਲ ਮਿਲ ਲੈਣਗੇ ਠੀਕ ਹੈ ਜੀ ਜਰੂ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜੀ ਠੀਕ ਹੈ ਸਰ ਓਕੇ ਜੀ ਓਕੇ